ਹੈਲੋ ਹਾਂਜੀ ਸਰ ਸੱਸਰੀਕਾਲ ਜੀ ਹਾਂਜੀ ਸਰ ਮੈਂ ਨਾ ਪੈਨ ਕਾਰਡ ਅਪਲਾਈ ਕੀਤਾ ਸੀਗਾ ਤੇ ਐਪਲੀਕੇਸ਼ਨ ਦੇ ਕੇ ਗਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਦੋ ਹਫਤੇ ਵਿੱਚ ਪੈਨ ਕਾਰਡ ਬਣ ਕੇ ਆਜੇਗਾ ਪਰ ਹਜੇ ਤੱਕ ਮੈਨੂੰ ਕੋਈ ਵੀ ਉਹਦੀ ਅਪਡੇਟ ਨਹੀਂ ਆਈ ਨਾ ਕੋਈ ਮੈਸੇਜ ਨਾ ਕੁਛ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕਦੋਂ ਤੱਕ ਮੇਰਾ ਜਿਹੜਾ ਪੈਨ ਕਾਰਡ ਆ ਉਹ ਬਣ ਜਾਏਗਾ ਮੈਂ ਦੋ ਤਿੰਨ ਵਾਰੀ ਆ ਕੇ ਸੁਵਿਧਾ ਸੈਂਟਰ ਵੀ ਪਤਾ ਕਰਕੇ ਗਈ ਆ ਪਰ ਮੈਨੂੰ ਉਹਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹਾਂਜੀ ਤੇ ਤੁਸੀਂ ਪਲੀਜ਼ ਜਲਦੀ ਥੋੜਾ ਜਿਹਾ ਮੈਨੂੰ ਇਹ ਕਨਫਰਮ ਕਰਕੇ ਦੱਸੋ ਵੀ ਮੇਰੀ ਜਿਹੜੀ ਐਪਲੀਕੇਸ਼ਨ ਆ ਉਹ ਐਕਸੈਪਟ ਹੋਈ ਵੀ ਆ ਕਿ ਨਹੀਂ ਜੇ ਨਹੀਂ ਹੋਈ ਤੇ ਫਿਰ ਮੈਂ ਕੋਈ ਦੁਬਾਰਾ ਆਪਦਾ ਫੋਰਮ ਫਿੱਲ ਕਰਕੇ ਐਪਲੀਕੇਸ਼ਨ ਦੁਬਾਰਾ ਦੇ ਕੇ ਜਾਵਾਂ ਹਾਂਜੀ ਮੈਂ ਪਹਿਲਾਂ ਵੀ ਸਰ ਆਪਦੀ ਐਪਲੀਕੇਸ਼ਨ ਦੇ ਕੇ ਗਈ ਆ ਤੇ ਮੇਰਾ ਰਸੀਦ ਨੰਬਰ ਉਹਦੇ ਉੱਪਰ ਮੇਰਾ ਨਾਮ ਰਾਜਵਿੰਦਰ ਕੌਰ ਹਾਂਜੀ ਤੇ ਮੇਰੀ ਡੇਟ ਆਫ ਬਰਥ ਚੌਦਾਂ ਸੱਤ ਉੱਨੀ ਸੌ ਬਿਆਸੀ ਸ੍ਰੀ ਮੁਖਤਸਰ ਸਾਹਿਬ ਹਾਂਜੀ ਇਹ ਮੇਰਾ ਐਡਰੈਸ ਆ ਪਲੀਜ਼ ਚੈੱਕ ਕਰਕੇ ਮੈਨੂੰ ਬੈਕ ਕਾਲ ਕਰਕੇ ਦੱਸਿਓ ਓਕੇ ਜੀ ਧੰਨਵਾਦ